ਮੇਰੀ ਸਭ ਤੋਂ ਪਸੰਦ ਦਾ ਮਨ ਪਸੰਦ ਯੋਗਾ ਪੋਜ ਅਨੁਲੋਮ ਵਿਲੋਮ ਹੈ ਅਨੁਲੋਮ ਵਿਲੋਮ ਮੈਨੂੰ ਇਸ ਕਰਕੇ ਪਸੰਦ ਹੈ ਕਿਉਂਕਿ ਇਸ ਦੇ ਨਾਲ ਆਪਾਂ ਆਪਣੇ ਮਨ ਨੂੰ ਬੜੀ ਹੀ ਜਲਦੀ ਸ਼ਾਂਤ ਕਰਕੇ ਇੱਕ ਧਿਆਨ ਵਿੱਚ ਲਗਾ ਸਕਦੇ ਹਾਂ ਅਨੁਲੋਮ ਵਿਲੋਮ ਇਕ ਇਹੋ ਜਿਹੀ ਕਿਰਿਆ ਹੈ ਜਿਹੜੀ ਕਿ ਛੋਟੇ ਬੱਚੇ ਤੋਂ ਲਗਾ ਕੇ ਤਿੰਨ ਚਾਰ ਸਾਲ ਦਾ ਬੱਚਾ ਜਿਹੜਾ ਕਿ ਯੋਗ ਨੂੰ ਥੋੜ੍ਹਾ ਬਹੁਤ ਵੀ ਸਮਝਣ ਯੋਗ ਹੋਵੇ ਉੱਥੋਂ ਲਗਾ ਕੇ ਤਾਂ ਭਾਵੇਂ ਨੱਬੇ ਸਾਲ ਦਾ ਬੱ ਪਰਸਨ ਹੋਵੇ ਨੱਬੇ ਸਾਲ ਦਾ ਵਿਅਕਤੀ ਹੋਵੇ ਉਹ ਵੀ ਇਸ ਨੂੰ ਬੜੀ ਹੀ ਆਸਾਨੀ ਦੇ ਨਾਲ ਕਰ ਸਕਦਾ ਹੈ ਅਨੁਲੋਮ ਵਿਲੋਮ ਇੱਕ ਇਹੋ ਜਿਹਾ ਪ੍ਰਾਣਾਯਾਮ ਹੈ ਇਹ ਯੋਗਾ ਦਾ ਹੀ ਇੱਕ ਭਾਗ ਹੈ ਇਹ ਇਕ ਇਹੋ ਜਿਹਾ ਪ੍ਰਾਣਾਯਾਮ ਹੈ ਇਸ ਦੇ ਵਿੱਚ ਕੋਈ ਖ਼ਾਸ ਲੰਬੇ ਚੌੜੇ ਪ੍ਰਿਆਸਾਂ ਦੀ ਜ਼ਰੂਰਤ ਨਹੀਂ ਪੈਂਦੀ ਇਸ ਲਈ ਮੈਨੂੰ ਇਹ ਬਹੁਤ ਹੀ ਪਸੰਦ ਹੈ ਭਾਵ ਉੱਪਰੋਂ ਇਹਦੇ ਜਿਹੜੇ ਲਾਭ ਹਨ ਇਹਦੇ ਜਿਹੜੇ ਫ਼ਾਇਦੇ ਹਨ ਉਹ ਵੀ ਬਹੁਤ ਜ਼ਿਆਦਾ ਹਨ ਕਿਸੇ ਵਿਅਕਤੀ ਨੂੰ ਨਜਲਾ ਹੋਵੇ ਜੁਕਾਮ ਹੋਵੇ ਜਾਂ ਉਹਦੇ ਸਿਰ ਦਰਦ ਹੁੰਦਾ ਹੋਵੇ ਜੇ ਉਹ ਨਿਯਮਿਤ ਤੌਰ 'ਤੇ ਅਨੁਲੋਮ ਬਿਲੋਮ ਕਰੇ ਤਾਂ ਉਹ ਇਹਨਾ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦਾ ਹੈ ਅਨੁਲੋਮ ਵਿਲੋਮ ਕਰਨ ਲਈ ਵਿਅਕਤੀ ਨੂੰ ਪਹਿਲਾਂ ਆਰਾਮ ਦੇ ਨਾਲ ਸੁਖਾਸਨ ਵਿੱਚ ਬੈਠਣਾ ਹੁੰਦਾ ਹੈ ਉਸ ਤੋਂ ਬਾਅਦ ਉਸ ਨੇ ਆਪਣਾ ਇੱਕ ਹੱਥ ਆਪਣੇ ਗੋਡੇ 'ਤੇ ਅਤੇ ਦੂਸਰਾ ਹੱਥ ਦੇ ਆਪਣੇ ਅੰਗੂਠੇ ਦੇ ਨਾਲ ਆਪਣੇ ਖੱਬੇ ਨੱਕ ਦੇ ਖੱਬੇ ਪਾਸੇ ਨੂੰ ਬੰਦ ਕਰਨਾ ਹੁੰਦਾ ਹੈ ਅਤੇ ਆਪਣੀਆਂ ਦੋ ਉਗਲਾਂ ਆਪਣੇ ਸਿਰ ਦੇ ਮੱਧਿਆ ਭਾਗ 'ਚ ਰੱਖਣੀਆਂ ਹੁੰਦੀਆਂ ਨੇ ਉਸ ਤੋਂ ਉਪਰੰਤ ਉਹਨੇ ਆਪਣੇ ਸੱਜੇ ਭਾਗ ਤੋਂ ਇੱਕ ਲੰਬਾ ਸਾਹ ਲੈਣਾ ਹੁੰਦਾ ਹੈ ਅਤੇ ਉਸ ਲੰਬੇ ਸਾਹ ਨੂੰ ਲੈ ਕੇ ਅਤੇ ਉਹਨੂੰ ਚਾਰ ਸਕਿੰਟ ਤੱਕ ਰੋਕਣਾ ਹੁੰਦਾ ਹੈ ਉਸ ਤੋਂ ਉਪਰੰਤ ਉਹਨਾਂ ਦੋਹਾਂ ਉਂਗਲਾਂ ਦੇ ਨਾਲ ਸੱਜਾ ਪਾਸਾ ਬੰਦ ਕਰਕੇ ਅਤੇ ਜਿਸ ਪਾਸੇ ਨੂੰ ਅੰਗੂਠੇ ਨਾਲ ਬੰਦ ਕੀਤਾ ਹੁੰਦਾ ਹੈ ਉਹ ਪਾਸਾ ਖੋਲ੍ਹ ਕੇ ਅਤੇ ਸਾਨੂੰ ਛੱਡਣਾ ਹੁੰਦਾ ਹੈ